ਮੇਰਾ ਫਸਟ ਪ੍ਰੋਡਕਟ ਫੋਰ ਵਾਏ ਫੋਰ ਮਹਿੰਦਰਾ ਥਾਰ ਸੀ ਇਹ ਥਾਰ ਲਈ ਨੂੰ ਮੈਨੂੰ ਤਕਰੀਬਨ ਤਿੰਨ ਸਾਲ ਹੋ ਗਏ ਨੇ ਇਹ ਬਹੁਤ ਹੀ ਵਧੀਆ ਕੰਪਨੀ ਦੇ ਉੱਤੇ ਫੋਰ ਵਾਏ ਫੋਰ ਥਾਰ ਹੈ ਇਸ ਵਿੱਚ ਜ਼ੋਰ ਬਹੁਤ ਏ ਜ਼ਿਆਦਾ ਏ ਕਿ ਮੈਂ ਉਹਨੂੰ ਪਹਾੜੀ ਏਰੀਆ 'ਚ ਵੀ ਲੈ ਕੇ ਗਿਆ ਏ ਉੱਥੇ ਕਦੇ ਦਬੀ ਨਹੀਂ ਜਿੰਨੀਆਂ ਮਰਜ਼ੀ ਇਹਦੇ 'ਤੇ ਸਵਾਰੀਆਂ ਚੜ੍ਹਾ ਲਓ ਜਿੰਨੇ ਜਿੱਥੇ ਇਹਨੂੰ ਮਰਜ਼ੀ ਲੈ ਜਾਉ ਇਹ ਬਹੁਤ ਹੀ ਵਧੀਆ ਮਹਿੰਦਰਾ ਥਾਰ ਬਹੁਤ ਹੀ ਜ਼ਿਆਦਾ ਵਧੀਆ ਇਹਦੀ ਐਵਰੇਜ ਵੀ ਬਹੁਤ ਹੀ ਜ਼ਿਆਦਾ ਵਧੀਆ ਹੋਰਾਂ ਗੱਡੀਆਂ ਨਾਲ਼ੋਂ ਅਤੇ ਇਹਦੀ ਸ਼ੋਅ ਵੀ ਬਹੁਤ ਵਧੀਆ ਲੋਕ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਮੈਂ ਜ਼ਿਆਦਾਤਰ ਇਹਨੂੰ ਕੋਲੇਜ ਲਈ ਯੂਜ਼ ਕਰਦਾਂ ਅਤੇ ਜਦੋਂ ਮੈਂ ਕਿਤੇ ਪਹਾੜੀ ਏਰੀਏ 'ਚ ਜਾਣਾ ਹੁੰਦਾ ਜਾਂ ਕਿਤੇ ਘੁੰਮਣ ਜਾਣਾ ਹੁੰਦਾ ਸ਼ਿਮਲਾ ਮਨਾਲੀ ਉੱਥੇ ਵੀ ਮੈਂ ਆਪਣੀ ਇਹ ਥਾਰ ਨੂੰ ਹੀ ਲੈ ਕੇ ਜਾਂਦਾ ਇਹਦੀ ਐਵਰੇਜ ਬਹੁਤ ਵਧੀਆ ਕਦੇ ਕਦੇ ਹੈਰਾਨ ਨਹੀਂ ਕਰਦੀ ਜਿਵੇਂ ਰਾਹ ਜਾਂਦੇ ਆਪਾਂ ਨੂੰ ਸੌ ਟੈਨਸ਼ਨਾਂ ਹੁੰਦੀਆਂ ਨੇ ਵੀ ਗੱਡੀ ਨਵੀਂ ਲਈ ਆ ਜਾਂ ਗੱਡੀ ਨੂੰ ਕੁਛ ਹੋ ਨਾ ਜਾਵੇ ਇਹ ਕੁਛ ਖ਼ਰਾਬ ਨਾ ਕਰੇ ਪਹਾੜੀ ਏਰੀਏ 'ਚ ਦੂਰ ਆਏ ਹੋਏ ਹਾਂ ਨਹੀਂ ਇੱਦਾਂ ਦੀ ਏ ਥਾਰ ਦੇ ਵਿੱਚ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਇਹ ਬਹੁਤ ਜ਼ਿਆਦਾ ਬਹੁਤ ਹੀ ਵਧੀਆ ਗੱਡੀ ਹੈ ਕਹਿਣ ਦਾ ਮਤਲਬ ਇਹਨੂੰ ਤੁਹਾਨੂੰ ਜ਼ਰੂਰ ਇਹਨੂੰ ਪਰਚੇਜ ਕਰਨਾ ਚਾਹੀਦਾ ਜਿੰਨਾਂ ਜਦੋਂ ਦੀ ਮੈਂ ਲਈ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਕੋਈ ਕੁਛ ਨਹੀਂ ਹੋਇਆ ਮੈਂ ਪਹਾੜੀ ਏਰੀਆ 'ਚ ਵੀ ਲੈ ਕੇ ਜਾਂਦਾ ਰਿਹਾ ਇਹਨੂੰ ਕਦੇ ਨਹੀਂ ਦਬੀ ਕਦੇ ਕੁਛ ਨਹੀਂ ਹੋਇਆ